ਹਾਂਜੀ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਇਹੋ ਜਿਹਾ ਰਾਜ ਹੈ ਜਿਹੜਾ ਪੂਰੀ ਤਰ੍ਹਾਂ ਖੇਤੀਬਾੜੀ ਨਾਲ ਖੇਤੀਬਾੜੀ 'ਤੇ ਨਿਰਭਰ ਅਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਰਾਜ ਹੈ ਜਿਹਦੇ ਪੰਜਾਬ ਰਾਜ ਦੇ ਵਿੱਚ ਦੇਸ਼ ਪੰਜਾਬ ਰਾਜ ਨੂੰ ਪੂਰੇ ਭਾਰਤ ਦਾ ਅੰਨਦਾਤਾ ਹੀ ਤਾਂ ਹੀ ਕਿਹਾ ਜਾਂਦਾ ਹੈ ਕਿਉਂਕਿ ਇੱਥ ਇਹ ਪੂਰਾ ਜਿਹੜਾ ਰਾਜ ਹੈ ਇਹ ਪ ਪੂਰਾ ਖੇਤੀ ਨਾਲ ਜੁੜਿਆ ਹੋਇਆ ਹੈ ਜਿਹੜੇ ਸੱਤਰ ਪ੍ਰਸੈਂਟ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਉਹ ਖੇਤੀ ਖੇਤੀਬਾੜੀ ਨਾਲ ਜੁੜੀ ਆਬਾਦੀ ਹੈ ਕਿਉਂਕਿ ਪੰਜਾਬ ਵਿੱਚ ਜਿਹੜਾ ਰੂਲਰ ਏਰੀਆ ਪੋਪੂਲੇਸ਼ਨ ਹੈ ਉਹ ਵੀ ਪ ਇੱਕ ਸ਼ਹਿਰੀ ਏਰੀਆ ਤੋਂ ਜ਼ਿਆਦਾ ਹੈ ਅਤੇ ਜਿਹੜਾ ਪੰਜਾਬ ਦੇ ਵਿੱਚ ਲੋਕ ਹੈ ਉਹਨਾਂ ਦੀ ਔਕੂਪੇਸ਼ਨ ਨੇ ਵੀ ਜ਼ਿਆਦਾਤਰ ਖੇਤੀਬਾੜੀ ਹੈ ਤਾਂ ਕਰਕੇ ਜਿਹੜਾ ਪੰਜਾਬ ਹੈ ਉਹ ਖੇਤੀ ਫ਼ਸਲਾਂ ਨਾਲ ਜਾਂ ਖੇਤੀ ਨਾਲ ਜੁੜਿਆ ਰਾਜ ਹੈ ਪੰਜਾਬ ਦੇ ਵਿੱਚ ਜਿਹੜੀਆਂ ਫ਼ਸਲਾਂ ਹੈ ਉਹ ਹਰ ਮੌਸਮ ਅਲੱਗ ਅਲੱਗ ਉਗਾਈਆਂ ਜਾਂਦੀਆਂ ਹਨ ਜਿਵੇਂ ਆਪਾਂ ਗਰਮੀ ਦੀ ਗੱਲ ਕਰੀਏ ਤਾਂ ਇੱਥੇ ਝੋਨਾ ਜਿਹੜਾ ਹੈ ਉਹ ਹੁਣ ਬਹੁਤ ਜ਼ਿਆਦਾ ਉਗਾਇਆ ਜਾਂਦਾ ਹੈ ਅਤੇ ਸਰਦੀ ਦੇ ਵਿੱਚ ਜਿਵੇਂ ਨਰਮਾ ਹੋ ਗਿਆ ਜਾਂ ਕਪਾਹ ਹੋ ਗਈ ਠੀਕ ਹੈ ਅਤੇ ਕਈ ਲੋਕ ਹੁਣ ਸਰਕਾਰਾਂ ਜ ਹੁਣ ਜੋ ਪੰਜਾਬ ਦੇ ਵਿੱਚ ਹੈ ਉਹ ਝ ਝੋਨੇ ਦੀ ਫ਼ਸਲ ਜਿਵੇਂ ਚਾਵਲ ਜਿਹੜੇ ਆ ਉਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਉਗਾਏ ਜਾ ਰਹੇ ਜਿਹਦੇ ਕਰਕੇ ਜਿਹੜਾ ਪਾਣੀ ਹੈ ਉਹ ਬਹੁਤ ਲੱਗ ਰਿਹਾ ਤਾਂ ਕਰਕੇ ਜਿਹੜੀ ਸਰਕਾਰ ਹੈ ਉਹ ਹਜੇ ਉਹ ਅਜੇ ਜਾਗਰੂਕ ਕਰ ਰਹੀ ਹੈ ਕਿਸਾਨਾਂ ਨੂੰ ਕਿ ਜਿਹੜਾ ਫ਼ਸਲ ਹੈ ਅ ਚਾਵਲ ਦੀ ਫ਼ਸਲ ਨੂੰ ਘੱਟ ਲਗਾਇਆ ਜਾਵੇ ਕੋਈ ਹੋਰ ਜਿਹੜੀਆਂ ਸਬਜ਼ੀਆਂ ਦੀ ਫ਼ਸਲ ਹੈ ਉਹ ਲਗਾਈਆਂ ਜਾਣ ਤਾਂ ਕਿ ਜਿਹੜੀ ਭੂਮੀ ਹੈ ਉਹ ਜਲਦੀ ਰੀਬਿਲਡ ਕਾ ਹੋ ਜਾਵੇ ਕਿਉਂਕਿ ਜਿਹੜੀ ਜਦੋਂ ਆਪਾਂ ਚਾਵਲ ਉਗਾਉਣੇ ਆ ਉਸ ਤੋਂ ਬਾਅਦ ਉਹਦੀ ਜਿਹੜੀ ਇੱਕ ਤਾਂ ਲਾਗਤ ਇੱਕ ਪਾਣੀ ਦੀ ਲਾਗਤ ਜ਼ਿਆਦਾ ਲੱਗਦੀ ਹੈ ਇੱਕ ਫਿਰ ਉਹ ਬਿਜਲੀ ਜ਼ਿਆਦਾ ਲੱਗਦੀ ਹੈ ਉੱਥੋਂ ਜਦੋਂ ਆਪਾਂ ਜਦੋਂ ਝੋਨੇ ਦੀ ਕਟਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਸਾੜਿਆ ਜਾਂਦਾ ਜਿਵੇਂ ਪਰਾਲੀ ਸਾੜੀ ਜਾਂਦੀ ਹੈ ਉਹਦੇ ਕਰਕੇ ਜਿਹੜੀ ਏਅਰ ਪਲਿ ਕਿਉਂਕਿ ਸਰਕਾਰ ਕੋਲੋਂ ਜੋ ਸ ਜਿਹੜੀਆਂ ਸੁਵਿਧਾਵਾਂ ਹਨ ਉਹ ਥੋੜ੍ਹੀਆਂ ਲਿਮਿਟਡ ਹਨ ਜਿਹਦੇ ਕਰਕੇ ਸ ਕਿਸਾਨ ਵੀ ਮਜਬੂਰ ਹੋ ਜਾਂਦਾ ਉਹ ਪਰਾਲੀ ਕੱਟਣ ਵਾਸਤੇ ਉਹ ਪਰਾਲੀ ਜਦੋਂ ਕੱਟੀ ਜਾਂਦੀ ਹੈ ਅਤੇ ਜਦੋਂ ਪਰਾਲੀ ਕੱਟੀ ਜਾਂਦੀ ਹੈ ਤਾਂ ਜਿਹੜਾ ਪ੍ਰਦੂਸ਼ਣ ਹੈ ਉਹ ਵੀ ਫੈਲਦਾ ਹੈ ਅਤੇ ਜਿਹਦੇ ਕਰਕੇ ਬੜੀਆਂ ਔਕੜਾਂ ਆਉਂਦੀਆਂ ਗ ਸਰਦੀ ਦੇ ਸੀਜ਼ਨ ਦੇ ਵਿੱਚ ਸਰਦੀ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਪੋਲਿਊਸ਼ਨ ਵੀ ਹੋ ਜਾਂਦਾ ਅਤੇ ਇਹ ਜੇ ਜੋ ਮੈਂ ਦੱਸਣਾ ਚਾਹੁੰਦਾ ਇਹ ਇਹ ਹੀ ਨੇ ਜਿਹਦੇ ਕਰ